ਮੈਂ ਆਪਣੇ ਜੀਵਨ ਵਿੱਚ ਸਭ ਤੋਂ ਆਸ ਅਸਾਧਾਰਨ ਅਤੇ ਦੁਰਲਭ ਪੰਛੀ ਚਿੜੀਆਂ ਨੂੰ ਹੀ ਦੇਖਿਆ ਹੈ ਮੈਨੂੰ ਲੱਗਦਾ ਹੈ ਪੰਛੀਆਂ ਵਿੱਚ ਚਿੜੀ ਇੱਕ ਐਸੀ ਪੰਛੀ ਹੈ ਜੋ ਸਭ ਤੋਂ ਅਸਾਧਾਰਨ ਅਤੇ ਦੁਰਲਭ ਹੈ ਉਹ ਮੈਨੂੰ ਇੱਦਾਂ ਲੱਗਦਾ ਹੈ ਕਿ ਉਹ ਸਭ ਤੋਂ ਡਰੀ ਡਰੀ ਰਹਿੰਦੀ ਹੈ ਅਤੇ ਨਾ ਅਤੇ ਕਿਸੇ ਮਨੁੱਖ ਨੂੰ ਵੇਖੇ ਤਾਂ ਨਾਲ ਹੀ ਉੱਡ ਜਾਂਦੀ ਹੈ ਉਸ ਦਾ ਸੁਭਾਅ ਬਹੁਤ ਹੀ ਡਰਿਆ ਡਰਿਆ ਹੈ ਅਤੇ ਲੇਕਿਨ ਉਸ ਦਾ ਚਰਿਤਰ ਬਹੁਤ ਸੋਹਣੀ ਹੈ ਆਕਾਰ 'ਚ ਉਹ ਬਹੁਤ ਛੋਟੀ ਹੁੰਦੀ ਹੈ ਅਤੇ ਲੇਕਿਨ ਹੁੰਦੀ ਬਹੁਤ ਸਮਝਦਾਰ ਹੈ ਪਰ ਉਸ ਦਾ ਸਰੀਰ ਬਹੁਤ ਹੀ ਅਸਾਧਾਰਨ ਅਤੇ ਦੁਰਲਭ ਹੈ ਮੈਨੂੰ ਇਹ ਲੱਗਦਾ ਹੈ ਕਿ ਜਿਸ ਤਰ੍ਹਾਂ ਹੋਰ ਚਿੜਿਆਂ ਦੀ ਕਮੀ ਹੋਵੇ ਖ਼ਤਮ ਹੋ ਗਈਆਂ ਹਨ ਇਸੇ ਤਰ੍ਹਾਂ ਮੈਨੂੰ ਲੱਗਦਾ ਹੈ ਇੱਕ ਦਿਨ ਐਸਾ ਆਏਗਾ ਜਦੋਂ ਚਿੜੀਆਂ ਦੀ ਪ੍ਰਜਾਤੀ ਵੀ ਖ਼ਤਮ ਹੋ ਜਾਏਗੀ ਇਸ ਕਰਕੇ ਸਾਨੂੰ ਇਹਨਾਂ ਚਿੜੀਆਂ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ ਚੀ ਇਹ ਚਿੜੀਆਂ ਅੱਜ ਕੱਲ੍ਹ ਕਿਉਂ ਖਤ ਤਾਰਾਂ ਦੀ ਵਜ੍ਹਾ ਨਾਲ ਖ਼ਤਮ ਹੋ ਰਹੀਆਂ ਹਨ ਕਿਉਂਕਿ ਇੰਨਾ ਨੈਟਵਰਕ ਹੋ ਗਿਆ ਹੈ ਕਿ ਜੋ ਕਿ ਇਹ ਸੰਭਾਲ ਨਹੀਂ ਇਹਨਾਂ ਦਾ ਦੁਰਲਭ ਸਰੀਰ ਸੰਭਾਲ ਨਹੀਂ ਪਾਉਂਦਾ ਅਤੇ ਇਹ ਕਮਜ਼ੋਰ ਹੈ ਅਤੇ ਇਸ ਕਰਕੇ ਇਹ ਖ਼ਤਮ ਹੋ ਰਹੀਆਂ ਹਨ ਕਈ ਟਾਵਰਾਂ ਦੇ ਲਾਗੇ ਦੇਖਿਆ ਜਾਂਦਾ ਹੈ ਕਿ ਚਿੜੀਆਂ ਮਰੀਆਂ ਹੋਈਆਂ ਲੱਭਦੀਆਂ ਹਨ ਹੁਣ ਇਹ ਆਪਣਾ ਬਸੇਰਾ ਘਰਾਂ ਵਿੱਚ ਬਣਾ ਰਹੀਆਂ ਹਨ ਧੰਨਵਾਦ